ਹਾਂ ਮੈਂ ਰੋਜ਼ਾਨਾ ਯੋਗਾ ਦਾ ਅਭਿਆਸ ਕਰਦਾ ਹਾਂ ਯੋਗਾ ਦਾ ਅਭਿਆਸ ਰੋਜ਼ਾਨਾ ਕਰਨ ਦੇ ਨਾਲ ਸਾਡੇ ਸਰੀਰਕ ਅਤੇ ਮਾਨਸਿਕ ਪ੍ਰਭਾਵ 'ਤੇ ਬਹੁਤ ਅਸਰ ਪੈਂਦਾ ਹੈ ਮਾਨਸਿਕ ਪ੍ਰਭਾਵ ਮਾਨਸੀ ਯੋਗਾ ਕਰਨ ਨਾਲ ਮਾਨਸਿਕ ਮਾਨਸਿਕ ਤੌਰ 'ਤੇ ਸਾਨੂੰ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਕੋਈ ਤਨਾਵ ਨਹੀਂ ਰਹਿੰਦਾ ਅਸੀਂ ਬਿਲਕੁਲ ਫਰੈਸ਼ ਮਹਿਸੂਸ ਕਰਦੇ ਹਾਂ ਬਿਮਾਰੀ ਨਹੀਂ ਲੱਗਦੀ ਸਰੀਰਕ ਤੌਰ 'ਤੇ ਅਸੀਂ ਤੰਦਰੁਸਤ ਮਹਿ ਰਹਿੰਦੇ ਹਾਂ ਅਤੇ ਸਾਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਬਿਮਾਰੀ ਨਹੀਂ ਲੱਗਦੀ ਰੋਜ਼ਾਨਾ ਯੋਗਾ ਕਰਨ ਦੇ ਨਾਲ ਰੋਜ਼ਾਨਾ ਯੋਗਾ ਕਰਨ ਦੇ ਨਾਲ ਸਾਡੇ ਸਰੀਰ ਦੇ ਵਿੱਚ ਇੱਕ ਲਚਕ ਪੈਦਾ ਹੋ ਜਾਂਦੀ ਹੈ ਅਸੀਂ ਕਿਸੇ ਵੀ ਪ੍ਰਕਾਰ ਦਾ ਕੰਮ ਬਹੁਤ ਆਸਾਨੀ ਨਾਲ ਕਰ ਸਕਦੇ ਹਾਂ ਯੋਗਾ ਕਰਨ ਨਾਲ ਸਾਡੇ ਸਰੀਰ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਬਿਮਾਰੀ ਨਹੀਂ ਲੱਗਦੀ ਯੋਗਾ ਕਰਨ ਯੋਗਾ ਕਰਨ ਤੋਂ ਬਾਅਦ ਸਰੀਰ ਪੂਰਾ ਐਨਰਜੀ ਨਾਲ ਭਰਿਆ ਹੋਇਆ ਲੱਗਦਾ ਹੈ ਯੋਗਾ ਦੇ ਬਹੁਤ ਸਾਰੇ ਆਸਨ ਹਨ ਜੋ ਕਿ ਸਾਡੇ ਸਰੀਰ ਦੀ ਗਰੋਥ ਵਾਸਤੇ ਬਹੁਤ ਆਵਸ਼ਕ ਹਨ ਯੋਗਾ ਕਰਨ ਦੇ ਨਾਲ ਸਾਡੇ ਸਰੀਰ ਦੀ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ ਯੋਗਾ ਕਰਨ ਦੇ ਨਾਲ ਸਾਡੇ ਸਰੀਰ ਦੇ ਵਿੱਚ ਇੱਕ ਨਈ ਊਰਜਾ ਪੈਦਾ ਹੁੰਦੀ ਹੈ ਯੋਗਾ ਕਰਨ ਨਾਲ ਸਾਨੂੰ ਬਿਲਕੁਲ ਹੀ ਵੀਕਨੈਸ ਨਹੀਂ ਮਹਿਸੂਸ ਹੁੰਦੀ ਹੈ ਅਤੇ ਕੋਈ ਵੀ ਕੰਮ ਕਰਨ ਦੇ ਵਿੱਚ ਸਾਨੂੰ ਉਤਸਾਹ ਪੈਦਾ ਹੁੰਦਾ ਹੈ ਯੋਗਾ ਕਰਨ ਦੇ ਨਾਲ ਸਾਨੂੰ ਹਮੇਸ਼ਾ ਫਰੈਸ਼ ਮਹਿਸੂਸ ਹੁੰਦਾ ਹੈ ਦਿਮਾਗ ਫਰੈਸ਼ ਰਹਿੰਦਾ ਹੈ ਸਰੀਰ ਦੇ ਵਿੱਚ ਚੁਸਤੀ ਸਫੁਰਤੀ ਰਹਿੰਦੀ ਹੈ ਮਾਸਪੇਸ਼ੀਆਂ ਖੁੱਲ ਜਾਂਦੀਆਂ ਹਨ